ਸਾਡੇ ਖੇਤਰਾਂ ਦੇ ਵਿੱਚ ਪਾਣੀ ਇੱਕ ਬਹੁਤ ਅਹਿਮ ਕੁਦਰਤੀ ਸਰੋਤ ਹੈ ਜਿਸਦੀ ਕਿ ਵਪਾਰਕ ਗਤੀਵਿਧੀਆਂ ਲਈ ਵਰਤੋਂ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜੋ ਇੱਥੋਂ ਥੋੜ੍ਹੀ ਹੀ ਦੂਰ ਜੋ ਦਰਿਆਵਾਂ ਦੇ ਕੰਡੇ 'ਤੇ ਰੇਤ ਹੈ ਉਹ ਵੱਖ ਵੱਖ ਜੋ ਇਮਾਰਤਾਂ ਨੇ ਉਹਨਾਂ ਨੂੰ ਬਣਾਉਣ ਦੇ ਲਈ ਉਹਦੀ ਸਪਲਾਈ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਜੋ ਪਹਾੜਾਂ ਦੇ ਉੱਤੇ ਬਜਰੀ ਰੇਤਾ ਉਹ ਇਹ ਸੰਬੰਧਿਤ ਜਿਹੜਾ ਹੋਰ ਜੋ ਵਸਤਾਂ ਨੇ ਉਹਦੀ ਉਹਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਇਹਨਾਂ ਸਭ ਦੇ ਵਿੱਚ ਅਹਿਮ ਪਾਣੀ ਹੈ ਜਿਹਦੀ ਕਿ ਵਰਤੋਂ ਦੇ ਨਾਲ ਨਾਲ ਕੁਵਰਤੋਂ ਵੀ ਕੀਤੀ ਜਾ ਰਹੀ ਹੈ ਸੋ ਇਸ ਸੰਬੰਧੀ ਧਿਆਨ ਦੇਣ ਦੀ ਲੋੜ ਹੈ